ਸਾਡੇ ਖੇਤਰ ਵਿੱਚ ਲੋਕਾਂ ਕੋਲ ਸੈਮਸੰਗ ਦਾ ਫੋਨ ਹੈ ਤਾਂ ਮੇਰੇ ਕੋਲ ਵੀ ਇਹੀ ਫੋਨ ਹੈ ਇਹ ਫੋਨ ਜਿਹੜਾ ਆ ਮੇਰੇ ਲਈ ਸੌਖਾ ਆ ਕਿਉਂਕਿ ਇਹਦੀ ਰੈਮ ਵਧੀਆ ਆ ਨਾਲੇ ਇਹਦੀ ਪਿੱਚਰ ਕੁਆਲਿਟੀ ਵੀ ਵਧੀਆ ਹੈ ਔਰ ਇਹਦੇ ਨਾਲ ਜਿਹੜਾ ਆਈਫੋਨ ਦੀ ਤਰ੍ਹਾਂ ਇਹਦੀ ਸਾਂਭ ਸੌਂਗ ਜਿਹੜੀ ਆ ਉਹ ਵੀ ਸੌਖੀ ਆ ਇਹ ਨਹੀਂ ਕਿ ਉਹਦੀ ਤਰ੍ਹਾਂ ਮਹਿੰਗਾ ਆ ਤਾਂ ਉਹਦੀ ਸਾਂਭ ਵੀ ਔਖ ਓਨੀ ਹੀ ਔਖੀ ਆ ਤਾਂ ਅਸੀਂ ਵੀ ਇਹਦੇ ਤੋਂ ਖੁਸ਼ ਹਾਂ ਕਿਉਂਕਿ ਬਾਕੀ ਸਾਰੇ ਜਿਹੜੇ ਲੋਕ ਆ ਉਹ ਵੀ ਇਹਨੂੰ ਵਰਤਦੇ ਨੇ ਖੁਸ਼ ਹੋ ਕੇ